ਪੰਜਾਬ 'ਚ ਵੈਸੇ ਤਾਂ ਬਹੁਤ ਤਰੀਕੇ ਦੇ ਵਪਾਰਕ ਜਿਹੜੀ ਪਹਿਲ ਕਦਮੀਆਂ ਉਹ ਕੀਤੀ ਜਾਂਦੀਆਂ ਹਨ ਪਰ ਜਿਹੜਾ ਸਭ ਤੋਂ ਮਸ਼ਹੂਰ ਜਿਹੜਾ ਪਹਿਲ ਕਦਮੀ ਮੈਨੂੰ ਲੱਗਦਾ ਹੈ ਉਹ ਹੈ ਆਪਣੀ ਖੇਤੀ ਪੰਜਾਬ ਕੋਲ ਕਿਉਂਕਿ ਬਹੁਤ ਹੀ ਵਧੀਆ ਤਰੀਕੇ ਦੇ ਜਿਹੜੇ ਖੇਤ ਹੈ ਉਹ ਉਪਲਬਧ ਹਨ ਅਤੇ ਇੱਥੇ ਜਿਹੜੀ ਆਪਣੇ ਕਿਸਾਨ ਭਾਈ ਹਨ ਉਹਨਾਂ ਨੂੰ ਬਹੁਤ ਤਰੀਕੇ ਦੀ ਸੁਵਿਧਾਵਾਂ ਜਿਹੜੀਆਂ ਸਰਕਾਰ ਦਿੰਦੀ ਹੈ ਅਤੇ ਜਿਹੜਾ ਪੰਜਾਬ ਹੈ ਉਹ ਗੇਹੂੰ ਅਤੇ ਗੰਨੇ ਲਈ ਬਹੁਤ ਹੀ ਪ੍ਰਸਿੱਧ ਹੈ ਜੋ ਕਿ ਇੱਕ ਬਹੁਤ ਹੀ ਵਪਾਰਕ ਮਾਧਿਅਮ ਜਿਹੜਾ ਹੈ ਬਣ ਸਕਦਾ ਤਾਂ ਜਿਹੜਾ ਪੂਰੇ ਵਰਲਡ 'ਚ ਜਿਹੜਾ ਫੋਰਟੀ ਪਰਸੈਂਟ ਜਿਹੜਾ ਐਕਸਪੋਰਟਰ ਹੈ ਉਹ ਪੰਜਾਬ ਹੀ ਹੈ ਤਾਂ ਜਿਹੜਾ ਕਿ ਪੰਜਾਬ ਦੇ ਉੱਪਰ ਸਰਕਾਰ ਜਿਹੜੀ ਹੈ ਇਸ ਤਰੀਕੇ ਦੀ ਮਸ਼ੀਨਰੀ ਇਸ ਤਰੀਕੇ ਦੇ ਕਿਸਾਨਾਂ ਨੂੰ ਆਪਣੀ ਸਿੰਚਾਈ ਲਈ ਪਾਣੀ ਅਤੇ ਹੋਰ ਵੀ ਬਹੁਤ ਤਰੀਕੇ ਦੇ ਜਿਹੜੇ ਸਾਧਨ ਹੈ ਉਹ ਪ੍ਰੋਵਾ ਪ੍ਰੋਵਾਈਡ ਕਰਵਾਉਂਦੀ ਹੈ ਤਾਂ ਕਿ ਜਿਹੜੇ ਸਾਡੇ ਕਿਸਾਨ ਹਨ ਅਤੇ ਜਿਹੜੇ ਸਾਡੇ ਵਪਾਰਕ ਕਰਮਚਾਰੀ ਹਨ ਅਤੇ ਲੋਕ ਹਨ ਉਹ ਅੱਗੇ ਵੱਧ ਸਕਣ